ਹਾਂ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ ਇਸ ਨੂੰ ਰੋਕਣ ਲਈ ਸਾਫ਼ ਪਾਣੀ ਅਤੇ ਸਵੱਛ ਹਵਾ ਦੀ ਚਿੰਤਾ ਕਰਨੀ ਚਾਹੀਦੀ ਹੈ ਅਤੇ ਸਿਹਤ ਸੁਧਾਰਾਂ ਲਈ ਨਿਯਮਤ ਜਾਂਚ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ ਸਿਹਤ ਸੁਧਾਰਾਂ ਲਈ ਪੜਤਾਲ ਕਰਵਾਉਣ ਲਈ ਤੁਹਾਨੂੰ ਨਿਯਮਤ ਚਿਕਿਤਸਕ ਦੀ ਸਲਾਹ ਲੈਣੀ ਚਾਹੀਦੀ ਹੈ ਚਿਕਿਤਸਕ ਤੁਹਾਨੂੰ ਸਿਹਤ ਜਾਂਚ ਕਰਵਾਉਂਦਾ ਹੈ ਅਤੇ ਤੁਹਾਡੇ ਲਈ ਉਚਿਤ ਇਲਾਜ ਦੇਵੇਗਾ ਇਸ ਤੋਂ ਇਲਾਵਾ ਸਿਹਤ ਸੁਧਾਰਾਂ ਲਈ ਨਿਯਮਤ ਵਾਧੂ ਸਰਵੇ 'ਤੇ ਜਾਣਕਾਰੀ ਪ੍ਰਾਪਤ ਕਰਨਾ ਵੀ ਬਹੁਤ ਮਹੱਤਵਪੂਰਨ ਹੈ ਸਿਹਤ ਨਾਲ ਜੁੜੇ ਬਿਮਾਰੀਆਂ ਨੂੰ ਰੋਕਣ ਲਈ ਨਿਯਮਤ ਰੋਜ਼ਾਨਾ ਵਰਦਾਨ ਰੱਖਣਾ ਬਹੁਤ ਜ਼ਰੂਰੀ ਹੈ ਤੁਸੀਂ ਨਿੰਬੂ ਪਾਣੀ ਸੁੰਦਰ ਨੀਂਦ ਸਵਸਥ ਖਾਣ ਪੀਣ ਅਤੇ ਯੋਗ ਜੈਸੇ ਸਵਸਥ ਆਦਤਾਂ ਅਪਣਾ ਕੇ ਸਿਹਤ ਨੂੰ ਸਧਾਰ ਕਰ ਸਕਦੇ ਹੋ